ਮੈਨੂੰ ਡਾਂਸ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਮੈਂ ਆਪਣੇ ਸਕੂਲ ਦੇ ਹਰ ਫੰਕਸ਼ਨ ਵਿੱਚ ਹਿੱਸਾ ਲੈਂਦੀ ਸੀ ਅਤੇ ਹਰ ਫੰਕਸ਼ਨ ਵਿੱਚ ਗਿੱਧਾ ਯਾ ਭੰਗੜਾ ਕਰਦੀ ਸੀ ਇਸ ਤੋਂ ਇਲਾਵਾ ਮੈਂ ਕੋਲਜ ਪੱਧਰ ਉੱਤੇ ਵੀ ਯੂਥ ਫੈਸਟ ਵਿੱਚ ਹਿੱਸਾ ਲਿਆ ਹੈ ਮੈਨੂੰ ਡਾਂਸ ਕਰਨ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਸ ਵਿੱਚ ਮੇਰਾ ਤਜਰਬਾ ਬਹੁਤ ਹੀ ਜ਼ਿਆਦਾ ਵਧੀਆ ਰਿਹਾ ਹੈ ਮੈਨੂੰ ਬਹੁਤ ਹੀ ਅਲੱਗ ਅਲੱਗ ਜ਼ਿਲਿਆਂ ਵਿੱਚ ਜਾ ਕੇ ਡਾਂਸ ਕਰਨ ਦਾ ਮੌਕਾ ਮਿਲਿਆ ਹੈ ਇਸ ਨਾਲ਼ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋਇਆ ਹੈ